ਅੱਜ ਕੱਲ੍ਹ ਤਾਂ ਵੈਸੇ ਖਾਣੇ ਦੀਆਂ ਬਹੁਤ ਸਾਰੀਆਂ ਵੈਰਾਇਟੀਜ਼ ਹੈਗੀਆਂ ਨੇ ਹੈ ਨਾ ਜੰਕ ਫੂਡ ਹੈ ਚਾਈਨੀਜ ਫੂਡ ਹੈ ਮਤਲਬ ਇੰਡੀਅਨ ਫੂਡ ਹੈ ਥਾਈ ਫੂਡ ਹੈ ਇਟਾਲੀਅਨ ਹੈ ਬਟ ਮੈਨੂੰ ਜਿਹੜਾ ਹੈ ਪਸੰਦ ਜਿਹੜਾ ਹੈ ਉਹ ਆਪਣਾ ਭਾਰਤੀ ਭੋਜਨ ਹੀ ਹੈ ਅਤੇ ਇਹਦੇ ਵਿੱਚ ਵੀ ਜਿਹੜਾ ਮੈਨੂੰ ਪੰਜਾਬੀ ਖਾਣਾ ਜਿੱਦਾਂ ਮਤਲਬ ਕਿ ਮੱਕੀ ਦੀ ਰੋਟੀ ਸਾਗ ਹੋ ਗਿਆ ਜਾਂ ਰਾਜਮਾਂਂਹ ਚਾਵਲ ਹੋ ਗਿਆ ਜਾਂ ਕੜੀ ਚਾਵਲ ਹੋ ਗਿਆ ਨਾ ਮੈਨੂੰ ਮੱਕੀ ਦੀ ਰੋਟੀ ਸਾਗ ਪਸੰਦ ਆ ਬਟ ਇਹ ਇੱਕ ਸ ਪਰ ਇੱਕ ਸੀਜ਼ਨਲ ਹੈਗਾ ਹਰ ਵੇਲੇ ਤਾਂ ਨਹੀਂ ਮ ਮਿਲ ਸਕਦਾ ਅਤੇ ਮੈਨੂੰ ਕੜੀ ਚਾਵਲ ਜਿਹੜੇ ਆ ਬਹੁਤ ਜ਼ਿਆਦਾ ਪਸੰਦ ਹੈ ਕੜੀ ਵੀ ਜਿਹੜੀ ਹੈ ਨਾ ਮਤਲਬ ਮੈਨੂੰ ਆਪਣੇ ਮਦਰ ਦੇ ਹੱਥਾਂ ਦੀ ਬਹੁਤ ਜ਼ਿਆਦਾ ਪਸੰਦ ਹੈ ਬਹੁਤੇ ਲੋਕ ਜਿਹੜੇ ਹੈ ਉਹ ਕੜੀ ਪਕੌੜਾ ਖਾਣਾ ਪਸੰਦ ਕਰਦੇ ਏ ਨਾ ਪਕੌੜਿਆਂ ਵਾਲੀ ਕੜੀ ਬਟ ਮੈਨੂੰ ਪਕੌੜੇ ਵਾਲੀ ਕੜੀ ਨਹੀਂ ਪਸੰਦ ਹੈ ਉਹਦੀ ਬਜਾਏ ਕਿ ਮੈਂ ਉਹਦੇ ਵਿੱਚ ਜਿਹੜਾ ਹੈ ਮਤਲਬ ਪਕੌੜਿਆਂ ਦੀ ਜਗ੍ਹਾ ਅਗਰ ਉਹਦੇ ਵਿੱਚ ਸਬਜ਼ੀਆਂ ਐਡ ਕਰ ਦਿੱਤੀਆਂ ਜਾਣ ਜਿਵੇਂ ਗੋਭੀ ਗਾਜਰ ਮਟਰ ਇਹ ਵਾਲੀ ਚੀਜ਼ ਮਤਲਬ ਐਡ ਕਰ ਦਿੱਤੇ ਜਾਣ ਉਹਦੇ ਨਾਲ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਔਰ ਕਿਉਂਕਿ ਕੜੀ ਜਿਹੜੀ ਹੈ ਲੱਸੀ ਜਿਹੜੀ ਹੈ ਉਹ ਤੁਹਾਨੂੰ ਹਰ ਵੇਲੇ ਅਵੇਲੇਬਲ ਹੁੰਦੀ ਏ ਅਤੇ ਤੁਸੀਂ ਜਦੋਂ ਮਰਜ਼ੀ ਕੜੀ ਬਣਾ ਸਕਦੇ ਹੋ ਹੈ ਨਾ ਅਤੇ ਉਹ ਆਪਣੇ ਸਵਾਦ ਅਨੁਸਾਰ ਜਿੱਦਾਂ ਦੀ ਵੀ ਤੁਹਾਨੂੰ ਚੰਗੀ ਲੱਗਦੀ ਪਰ ਮੈਨੂੰ ਆਪਣੇ ਮਦਰ ਦੇ ਹੱਥਾਂ ਦੀ ਕੜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਸੰਦ ਹੈ ਮੈਂ ਥੋੜ੍ਹੀ ਜਿਹੀ ਮਤਲਬ ਮੈਨੂੰ ਹੁੰਦਾ ਏ ਕਿ ਕੜੀ ਦਾ ਕਲਰ ਜਿਹੜਾ ਹੈ ਉਹ ਵੀ ਬਿਲਕੁਲ ਵਧੀਆ ਹੋਵੇ ਬਹੁਤ ਜ਼ਿਆਦਾ ਡਾਰਕ ਨਾ ਹੋਵੇ ਬਹੁਤ ਜ਼ਿਆਦਾ ਲਾਈਟ ਵੀ ਨਾ ਹੋਵੇ ਮਤਲਬ ਕੜੀ ਦਾ ਟੇਸਟ ਖੱਟੀ ਵੀ ਚਾਹੀਦੀ ਹੈ ਸੋ ਇਸ ਕਰਕੇ ਜਿਹੜੇ ਮੈਨੂੰ ਕੜੀ ਚਾਵਲ ਜਿਹੜੇ ਹੈ ਉਹ ਬਹੁਤ ਜ਼ਿਆਦਾ ਪਸੰਦ ਹੈ